ਆਵਾਜਾਈ ਦੇ ਸਭ ਤੋਂ ਆਮ ਸਾਧਨ ਜੇ ਅਸੀਂ ਯਾਤਰਾ ਅ ਕਰਦੇ ਹਾਂ ਚਾਹੇ ਦਿੱਲੀ ਜਾਂਦੇ ਹਾਂ ਚਾਹੇ ਹਜ਼ੂਰ ਸਾਹਿਬ ਗਏ ਅਸੀਂ ਪਠਾਨਕੋਟ ਗਏ ਚੰਡੀਗੜ੍ਹ ਗਏ ਤਾਂ ਜ਼ਿਆਦਾਤਰ ਅਸੀਂ ਰੇਲ ਗੱਡੀ ਨੂੰ ਹੀ ਆਪਣਾ ਜਿਹੜਾ ਆ ਉਹ ਸਾਧਨ ਬਣਾਉਂਦੇ ਹਾਂ ਕਿਉਂਕਿ ਉਹਦੇ ਵਿੱਚ ਯਾਤਰਾ ਕਰਨੀ ਬਹੁਤ ਆਰਾਮਦਾਇਕ ਹੈ ਇੱਕ ਤਾਂ ਬੈਠਣ ਉੱਠਣ ਖਾਣ ਪੀਣ ਇੱਧਰ ਉੱਧਰ ਜਾਣ ਦੀ ਕੋਈ ਮੁਸ਼ਕਿਲ ਨਹੀਂ ਹੁੰਦੀ ਅਤੇ ਬੜਾ ਆਰਾਮ ਨਾਲ ਤੁਸੀਂ ਜਿਹੜਾ ਪਹੁੰਚ ਸਕਦੇ ਹੋ ਇੱਕ ਬਾਹਰ ਦਾ ਦ੍ਰਿਸ਼ ਜਿਹੜਾ ਹੈ ਉਹ ਬਹੁਤ ਵਧੀਆ ਲੱਗਦਾ ਆ ਅਤੇ ਯਾਦਗਾਰ ਇਹ ਹੈ ਕਿ ਇਸ ਵਾਰ ਜਦੋਂ ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀ ਅਤੇ ਸਾਡੀ ਟਿਕਟ ਜਿਹੜੀ ਸੀ ਉਹ ਗੁੰਮ ਹੋ ਗਈ ਸੀ ਸੋ ਟਿਕਟ ਗੁੰਮ ਹੋਣ ਕਾਰਨ ਸਾਨੂੰ ਥੋੜ੍ਹੀ ਪਰੇਸ਼ਾਨੀ ਹੋਈ ਕਿ ਜੇਕਰ ਟੀ ਟੀ ਆਇਆ ਤਾਂ ਉਸਨੂੰ ਕੀ ਟਿਕਟ ਦਿਖਾਵਾਂਗੇ ਫਿਰ ਅਸੀਂ ਕੀ ਕੀਤਾ ਕਿ ਅਸੀਂ ਟਰੇਨ ਦੇ ਵਿੱਚ ਚੜ ਗਏ ਅਤੇ ਸਾਨੂੰ ਜਿਹੜਾ ਟੀ ਟੀ ਸੀ ਉਸਨੇ ਕਿਹਾ ਕਿ ਟਿਕਟ ਦਿਖਾਓ ਸਾਡੇ ਕੋਲ ਟਿਕਟ ਹੈਗੀ ਨਹੀਂ ਸੀ ਪਰ ਉਹਨੇ ਸਾਡੇ 'ਤੇ ਇਲਜ਼ਾਮ ਲਾਇਆ ਸ਼ਾਇਦ ਅਸੀਂ ਟਿਕਟ ਨਹੀਂ ਲਈ ਸੋ ਅਸੀਂ ਆਪਣੇ ਬੇਟੇ ਨਾਲ ਸੀ ਅਸੀਂ ਆਪਣੇ ਬੇਟੇ ਨੂੰ ਇੱਕ ਬਾਕਸ ਦੇ ਵਿੱਚ ਬਿਠਾਇਆ ਇੱਕ ਸ਼ਪੈਸ਼ਲ ਡੱਬੇ ਦੇ ਵਿੱਚ ਅਤੇ ਆ ਉਸ ਟੀ ਟੀ ਨੇ ਸਾਨੂੰ ਦੂਜੇ ਡੱਬੇ ਦੀਆਂ ਟਿਕਟਾਂ ਜਿਹੜੀਆਂ ਉਹ ਦੇ ਦਿੱਤੀਆਂ ਸੀ ਅਤੇ ਮਜਬੂਰਨ ਸਾਨੂੰ ਉੱਧਰ ਜਾਣਾ ਪਿਆ ਸੋ ਉਹਦੇ ਨਾਲ ਸਾਡਾ ਜਿਹੜਾ ਬੇਟਾ ਸੀਗਾ ਉਹ ਇਕੱਲਾ ਇੱਥੇ ਰਹਿ ਗਿਆ ਅਤੇ ਥੋੜ੍ਹਾ ਪਰੇਸ਼ਾਨ ਹੋ ਗਿਆ ਫਿਰ ਜਦੋਂ ਇੱਕ ਸਟੇਸ਼ਨ 'ਤੇ ਗੱਡੀ ਰੁਕੀ ਤਾਂ ਅਸੀਂ ਮਤਲਬ ਕਿ ਜਲਦੀ ਜਲਦੀ ਟੀ ਟੀ ਨੂੰ ਕਿਹਾ ਕਿ ਸਾਨੂੰ ਪਲੀਜ਼ ਉਸ ਕਮਰੇ ਵਿੱਚ ਜਾਂ ਉਸ ਡੱਬੇ ਵਿੱਚ ਜਾਣ ਦਿੱਤਾ ਜਾਵੇ ਜਿੱਥੇ ਸਾਡਾ ਬੇਟਾ ਆ ਫਿਰ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਅਤੇ ਉਹਨਾਂ ਦੱਸ ਪੰਦਰਾਂ ਮਿੰਟ ਬਾਅਦ ਸਾਨੂੰ ਆਪਣੇ ਬੱਚੇ ਲਾਗੇ ਉਹਨਾਂ ਨੇ ਜਾਣ ਦਿੱਤਾ ਅਤੇ ਉੱਥੋਂ ਦੀਆਂ ਹੀ ਸੀਟਾਂ ਸਾਨੂੰ ਜਿਹੜੀਆਂ ਉਹਦੀ ਟਿਕਟ ਦੇ ਦਿੱਤੀ ਸੋ ਇਹ ਗੱਲ ਯਾਦਗਾਰ ਹੈ ਸਾਡੀ ਬਹੁਤ ਵੱਡੀ ਸੋ ਥੈਂਕ ਯੂ ਧੰਨਵਾਦ